ਹੈਲੋ ਸਰ ਤੁਸੀਂ ਆਨੰਦ ਰੈਸਟੋਰੈਂਟ 'ਚੋਂ ਬੋਲ ਰਹੇ ਜੀ ਮੈਂ ਹੀਰਾ ਸਿੰਘ ਮਾਨਾਵਾਲਾ ਤੋਂ ਬੋਲਦਾ ਜੀ ਸਰ ਮੈਂ ਡਿਲੀਵਰੀ ਬਾਰੇ ਜਾਣਕਾਰੀ ਲੈਣੀ ਹੈ ਤੁਸ ਤੁਹਾਡੀ ਕੀ ਸਰਵਿਸ ਹੈ ਸਰ ਯਾਤਰਾ ਕਰਦੇ ਸਮੇਂ ਤੁਸੀਂ ਡਿਲੀਵਰੀ ਕਰ ਸਕਦੇ ਹੋ ਜਾਂ ਬਾਰਿਸ਼ ਦੇ ਮੌਸਮ ਵਿੱਚ ਵੀ ਤੁਸੀਂ ਡਿਲਵਰੀ ਕਰ ਸਕਦੇ ਹੋ ਤੁਸੀਂ ਕਿੰਨੇ ਟਾਈਮ ਤੱਕ ਡਿਲਵਰੀ ਕਰ ਸਕਦੇ ਹੋ ਜੀ ਜੇ ਸਵੇਰ ਨੂੰ ਅਸੀਂ ਕਾਲ ਕਰਨੀ ਹੈ ਤਾਂ ਕਿਹੜੇ ਟਾਈਮ ਕਰ ਸਕਦੇ ਹਾਂ ਜੀ ਜਾਂ ਰਾਤ ਨੂੰ ਕਿੰਨੇ ਸਮੇਂ ਤੱਕ ਸਰਵਿਸ ਹੈ ਜੀ ਬਸ ਇਹੀ ਜਾਣਕਾਰੀ ਚਾਹੁੰਦੇ ਹਾਂ ਜੀ ਅਸੀਂ ਤੁਹਾਡੇ ਕੋਲੋਂ ਸਮਾਨ ਤੁਸੀਂ ਤਾਜ਼ਾ ਪਹੁੰਚਾਉਂਦੇ ਹੋ ਧੰਨਵਾਦ